ਔਟੋ ਟਿਊਨ ਗਾਈਕੀ ਇੱਕ ਡਿਜੀਟਲ ਟੈਕਨੋਲਜੀ ਹੈ ਜੋ ਕਿ ਗਾਇਕ ਦੀ ਆਵਾਜ਼ ਵਿੱਚ ਸੁਰੀਲੇਪਣ ਦੀ ਗਲਤੀ ਨੂੰ ਠੀਕ ਕਰਦੀ ਹੈ ਅਤੇ ਗਾਇਕ ਨੂੰ ਇੱਕ ਅਲੱਗ ਸਮੂਹ ਸੌਂਪ ਦਿੰਦੀ ਹੈ ਪੰਜਾਬੀ ਸੰਗੀਤ ਉਦਯੋਗ ਵਿੱਚ ਕਈ ਗਾਇਕ ਓਟੋ ਟਿਊਨ ਦੀ ਵਰਤੋਂ ਕਰਦੇ ਹਨ ਖ਼ਾਸ ਕਰਕੇ ਹਿਪ ਹੋਪ ਅਤੇ ਮਾਡਰਨ ਪੰਜਾਬੀ ਮਿਊਜਿਕ ਵਿੱਚ ਕੁਝ ਅਜਿਹੇ ਵੀ ਗਾਇਕ ਹਨ ਜਿਹੜੇ ਕਿ ਓਟੋ ਟਿਊਨ ਦੀ ਵਰਤੋਂ ਕਰਦੇ ਹਨ ਪਰ ਮੈਨੂੰ ਉਹਨਾਂ ਦੇ ਨਾਮ ਨਹੀਂ ਪਤਾ ਇਹ ਲਾਈਵ ਗਾਇਕੀ ਵਿੱਚ ਇੱਕ ਚੈਲਜ ਵੀ ਬਣ ਸਕਦਾ ਹੈ ਕਿਉਂਕਿ ਬਹੁਤ ਸਾਰੇ ਓਟੋ ਟਿਊਨ 'ਤੇ ਆਧਾਰਿਕ ਲਾਈਕ ਲਾਈਵ ਪਰਫੋਰਮੈਂਸ ਵਿੱਚ ਆਪਣੀ ਅਸਲ ਗਾਇਕੀ ਦਿਖਾਉਣ ਵਿੱਚ ਫੇਲ ਹੋ ਜਾਂਦੇ ਹਨ ਲਾਈਵ ਗਾਇਕੀ ਵਿੱਚ ਇੱਕ ਅਸਲੀ ਫੀਲ ਅਤੇ ਤਜ਼ਰਬਾ ਹੁੰਦਾ ਹੈ ਜੋ ਕਿ ਓਟੋ ਟਿਊਨ ਗਾਇਕੀ ਵਿੱਚ ਨਾਲ ਖ਼ਤਮ ਹੋ ਜਾਂਦਾ ਹੈ ਇਸ ਕਰਕੇ ਜੇਕਰ ਕੋਈ ਗਾਇਕ ਓਟੋ ਟਿਊਨ ਵਰਤ ਕੇ ਗੀਤਾਂ ਨੂੰ ਸੁਣਨਯੋਗ ਬਣਾਉਂਦਾ ਹੈ ਤਾਂ ਇਹ ਵੀ ਇੱਕ ਸਕਿਲ ਹੈ ਪਰ ਲਾਈਵ ਗਾਇਕੀ ਹਮੇਸ਼ਾਂ ਇੱਕ ਵੱਡੀ ਕਾਬਲੀਅਤ ਮੰਨੀ ਜਾਂਦੀ ਹੈ ਧੰਨਵਾਦ